ਸੱਭਿਆਚਾਰਕ ਦਾ ਹੀਣ ਭਾਵ ਯਾਦ ਕਰ ਰਹੇ ਹਾਂ ਉਦੋਂ ਪਹਿਲਾਂ ਕੋਈ ਹੀ ਮਨੋਰੰਜਨ ਅਖਾੜਿਆਂ ਨਾਲ ਹੀ ਕਰਦੇ ਸੀ ਸ਼ਰੀਫ ਸਾਹਿਬ ਦੇ ਅਖਾੜੇ ਲੱਗਣੇ ਰਮਲੇ ਸਾਹਿਬ ਦੇ ਲੱਗਣੇ ਮਾਣਕ ਦੇ ਗਾਣੇ ਲੱਗਣੇ ਆਪਣਾ ਦੂਜਾ ਆਪਣਾ ਅਖਾੜੇ ਲੱਗਣੇ ਬਹੁਤ ਵਧੀਆ ਲੱਗਦਾ ਸੀ ਉਦੋਂ ਇਹੀ ਇੰਜੋਏਮੈਂਟ ਹੁੰਦਾ ਸੀ ਅਸੀਂ ਜਾਣਾ ਉਦੋਂ ਸਕੂਲ ਵੀ ਸਾਈਕਲਾਂ 'ਤੇ ਜਾਂਦੇ ਸੀ ਅਤੇ ਅਸੀਂ ਅਖਾੜੇ ਅਖੁੜੇ ਵੇਖਣ ਨੂੰ ਵੀ ਤੁਰ ਕੇ ਜਾਂਦੇ ਜਾਂ ਸਾਇਕਲਾਂ 'ਤੇ ਜਾਣਾ ਉਦੋਂ ਨਾ ਤਾਂ ਕਾਰਾਂ ਸੀ ਨਾ ਕੋਈ ਹੋਰ ਸੀ ਅਤੇ ਹੱਸ ਹੱਸ ਵਧੀਆ ਇੰਜੋਏ ਕਰਦੇ ਸੀ ਵਧੀਆ ਅਖਾੜੇ ਨੂੰ ਵਧੀਆ ਉੱਥੇ ਬੈਠ ਕੇ ਵਧੀਆ ਯਾਨੀ ਕਿ ਲੋਕ ਇੱਕ ਦੂਜੇ ਨੂੰ ਚਾਹੁੰਦੇ ਸੀ ਔਰ ਬਹੁਤ ਪ੍ਰੇਮ ਭਰਾਵ ਕਰਦੇ ਸੀ ਕੋਈ ਲੜਾਈ ਝਗੜਾ ਨਹੀਂ ਸੀ ਔਰ ਬਹੁਤ ਵਧੀਆ ਮਾਹੌਲ ਸੀਗਾ